ਕੁਝ ਸਾਲ ਪਹਿਲਾਂ ਦੇ ਪੁਰਾਣੇ ਮੋਬਾਇਲ ਅਤੇ ਮੌਜੂਦਾ ਸਮਾਰਟਫ਼ੋਨ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਕਿਉਂਕਿ ਪਹਿਲਾਂ ਸਿਪੰਲ ਅਤੇ ਬਟਨਾਂ ਵਾਲੇ ਫ਼ੋਨ ਹੁੰਦੇ ਸਨ ਪ੍ਰੰਤੂ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਮਾਰਟਫ਼ੋਨ ਆ ਗਏ ਹਨ ਜੋ ਕਿ ਟੱਚ ਸਕਰੀਨ ਦੇ ਨਾਲ਼ ਰਿਲੇਟਿਡ ਹਨ ਪਹਿਲਾਂ ਸਿਰਫ਼ ਕੌਲ ਜਾਂ ਮੈਸਿਜ ਹੀ ਹੁੰਦੇ ਸਨ ਪਰ ਹੁਣ ਸਾਰਾ ਕੁਛ ਫ਼ੋਨਾਂ ਰਾਹੀਂ ਹੁੰਦਾ ਹੈ ਇਸਦੇ ਵਿੱਚ ਇੰਟਰਨੈੱਟ ਸੇਵਾ ਵੀ ਬਹੁਤ ਹੀ ਵਧੀਆ ਸੀਗੀ ਅਤੇ ਇਹ ਫਾਈਵ ਜੀ ਫੌਰ ਜੀ ਸਾਰੇੇ ਆ ਗਏ ਸਨ ਉਸ ਤੋਂ ਬਾਅਦ ਇਸਦੇ ਰਾਹੀਂ ਅਸੀਂ ਯੂਟਿਊਬ ਵੀ ਦੇਖਦੇ ਹਨ ਮੈਪਸ ਵੀ ਗੂਗਲ ਸ਼ੋਸ਼ਲ ਮੀਡੀਆ ਐਪਸ ਸਾਰੇ ਇ ਇਨ੍ਹਾਂ ਦੇ ਉੱਤੇ ਹੀ ਕਰਦੇ ਹਨ ਇਸ ਦੇ ਉੱ ਉੱਤੇ ਅਸੀਂ ਔਨਲਾਈਨ ਟਿੱਕਟਸ ਵੀ ਬੁੱਕ ਕਰ ਸਕਦੇ ਹਨ ਔਨਲਾਈਨ ਸ਼ੌਪਿੰਗ ਕਰ ਸਕਦੇ ਹਨ ਅਤੇ ਆਪਣਾ ਫੂਡ ਵੀ ਓਡਰ ਕਰ ਸਕਦੇ ਹਨ ਬਟ ਪਹਿਲਾਂ ਦੇ ਟਾਈਮ ਵਿੱਚ ਸਿਰਫ਼ ਰੇਡੀਓ ਹੁੰਦਾ ਸੀ ਟੀ ਵੀ ਵਗੈਰਾ ਹੁੰਦੇ ਸੀ ਸਾਨੂੰ ਖ਼ੁਦ ਜਾ ਕੇ ਫਿਰ ਪ੍ਰੋਡਕਟ ਖਰੀਦਣਾ ਪੈਂਦਾ ਸੀ ਪਰ ਹੁਣ ਸਾਰਾ ਕੁਛ ਔਨਲਾਈਨ ਹੋ ਗਿਆ ਹੈ ਜਿਸਦੇ ਕਰਕੇ ਸਾਨੂੰ ਕਿਤੇ ਜਾਣਾ ਨਹੀਂ ਪੈਂਦਾ ਅਤੇ ਸਮਾਰਟਫ਼ੋਨ ਨੂੰ ਕੈਰੀ ਕਰਨਾ ਹੀ ਬਹੁਤ ਸੌਖਾ ਹੈ ਪਹਿਲਾਂ ਇਹਦੇ ਪਹਿਲਾਂ ਵਾਲੇ ਫ਼ੋਨਾਂ ਵਿੱਚ ਕੈਮਰਾ ਦੀ ਕੁਆਲਟੀ ਕੁਛ ਵੀ ਨਹੀਂ ਸੀ ਨਾ ਕੈਮਰਾ ਸੀ ਪ੍ਰੰਤੂ ਅੱਜ ਦੇ ਸਮਾਰਟਫ਼ੋਨ ਵਿੱਚ ਕੈਮਰਾ ਮਿਊਜਿਕ ਹਰ ਇੱਕ ਦ ਚੀਜ਼ ਹੈਗੀ ਹੈ ਜਿਹਦੇ ਕਰਕੇ ਸਾਨੂੰ ਮਿਊਜ਼ਿਕ ਸਿਸਟਮ ਲਿਆਉਣਾ ਨਹੀਂ ਪੈਂਦਾ ਸਾਡੇ ਫ਼ੋਨ ਦੇ ਵਿੱਚ ਹੀ ਉਪਲਬਧ ਹੁੰਦਾ ਹੈ ਮੈਂ ਜੀਓ ਕੰਪਨੀ ਦਾ ਸਿੰਮ ਯੂਜ਼ ਕਰਦੀ ਸੀ ਜਿਹਦੇ ਵਿੱਚ ਦੋ ਸ ਦੋ ਸੌ ਉਨਤਾਲੀ ਦਾ ਡਾਟਾ ਹੁੰਦਾ ਰਿਚਾਰਜ ਹੁੰਦਾ ਸੀ ਅਤੇ ਇੱਕ ਪੁਆਇੰਟ ਫਾਈਵ ਡਾ ਇੱਕ ਪੁਆਇੰਟ ਫਾਈਵ ਜੀ ਬੀ ਡਾਟਾ ਪ੍ਰਾਪਤ ਹੁੰਦਾ ਸੀ ਇਸਦੇ ਵਿੱਚ ਅਨਲਿਮਿਡ ਕਾਲਿੰਗ ਅਤੇ ਸੌ ਐੱਸ ਮੈ ਐੱਸ ਹੁੰਦੇ ਸਨ